ਰੂਪਨਗਰ ਜ਼ਿਲ੍ਹੇ ਦੇ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਨੇ ਜਿਵੇਂ ਕਿ ਦੀਵਾਲੀ ਹੋਲੀ ਅ ਲੋਹੜੀ ਇਹ ਸਾਰੇ ਤਿਉਹਾਰ ਮਨਾਏ ਜਾਣ ਵਾਲੇ ਨੇ ਪਰ ਜੋ ਸੱਭਿਆਚਾਰਕ ਤਿਉਹਾਰ ਸਾਡੇ ਨੇ ਉਹ ਸਰਸ ਮੇਲਾ ਅਤੇ ਸ਼ਹੀਦੀ ਜੋੜ ਮੇਲਾ ਰੋਪੜ ਦੇ ਵਿੱਚ ਮੁੱਖ ਤੌਰ 'ਤੇ ਮਨਾਏ ਜਾਂਦੇ ਨੇ ਸਰਸ ਮੇਲਾ ਕਰੀਬ ਇੱਥੇ ਚਾਰ ਕੁ ਸਾਲਾਂ ਬਾਅਦ ਇੱਕ ਵਾਰੀ ਰਣਜੀਤ ਸਿੰਘ ਬਾਗ ਦੇ ਵਿੱਚ ਮਨਾਇਆ ਜਾਂਦਾ ਹੈ ਉੱਥੇ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਨੇ ਅਤੇ ਝੂਲੇ ਲ ਲਗਾਏ ਜਾਂਦੇ ਨੇ ਜਿਹੜੇ ਵੱਖ ਵੱਖ ਸਕੂਲਾਂ ਤੋਂ ਬੱਚੇ ਆਪਣੀਆਂ ਜਿਹੜੀਆਂ ਨੇ ਪ੍ਰਫੋਰਮੈਂਸਾਂ ਆ ਕੇ ਉਸ ਮੇਲੇ ਦੇ ਵਿੱਚ ਦਿੰਦੇ ਨੇ ਅਤੇ ਇਸ ਤੋਂ ਬਾਅਦ ਸ਼ਹੀਦੀ ਜੋੜ ਮੇਲਾ ਅ ਕ ਗੁਰਦੁਆਰਾ ਭੱਠਾ ਸਾਹਿਬ ਦੇ ਵਿੱਚ ਮਨਾਇਆ ਜਾਂਦਾ ਉੱਥੇ ਲੋਕ ਬ ਸਭ ਧਰਮਾਂ ਦੇ ਲੋਕ ਆ ਕੇ ਨਤਮਸਤਕ ਹੁੰਦੇ ਨੇ ਅਤੇ ਇਸ ਧਰ ਇਸ ਮੇਲੇ ਦੇ ਵਿੱ ਸ਼ਹੀਦੀ ਜੋੜ ਮੇਲੇ ਦੇ ਵਿੱਚ ਲੋਕਾਂ ਦੇ ਵਿੱਚ ਕੋਈ ਭੇਦ ਭਾਵ ਨਹੀਂ ਹੁੰਦਾ ਸਭ ਆ ਕੇ ਆਪਣੇ ਆਪਣੇ ਧਰਮਾਂ ਅਲੱਗ ਅਲੱਗ ਧਰਮਾਂ ਤੋਂ ਆ ਕੇ ਉੱਥੇ ਨਤਮਸਤਕ ਹੁੰਦੇ ਨੇ